ਹਾਂ ਅਖ਼ਬਾਰਾਂ ਵਿੱਚ ਤਾਂ ਕਈ ਹੱਦ ਤੱਕ ਖਬਰਾਂ ਸੱਚ ਹੀ ਹੁੰਦੀਆਂ ਹਨ ਪਰ ਕਈ ਵਾਰ ਮੋਬਾਇਲ ਅਤੇ ਰੇਡੂਏ ਵਿੱਚ ਖਬਰਾਂ ਜੋ ਭੇਜੀਆਂ ਜਾਂਦੀਆਂ ਹਨ ਉਹ ਗਲਤ ਵੀ ਹੁੰਦੀਆਂ ਹਨ ਕਈ ਵਾਰ ਮੋਬਾ ਇਲ ਵਿੱਚ ਫੀਡ ਖਬਰਾਂ ਬਹੁਤ ਹੀ ਗਲਤ ਹੁੰਦੀਆਂ ਹਨ ਜੋ ਕਿ ਸਰਕਾਰ ਨੇ ਕਦੇ ਕਿਹਾ ਵੀ ਨਹੀਂ ਹੁੰਦਾ ਉਸ ਬਾਰੇ ਹੀ ਹੀ ਮੋਬਾਇਲ ਵਿੱਚ ਭੇਜਿਆ ਜਾਂਦਾ ਹੈ ਜੋ ਕਿ ਲੋਕਾਂ ਨੂੰ ਬਹੁਤ ਹੀ ਨੁਕਸਾਨ ਦਿੰਦਾ ਹੈ ਕਈ ਵਾਰ ਤਾਂ ਸਰਕਾਰ ਦੀਆਂ ਯੋਜਨਾਵਾਂ ਬਾਰੇ ਹਜੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਜੋ ਕਿ ਮੋਬਾਇਲ ਵਿੱਚ ਪਹਿਲਾਂ ਤੋਂ ਹੀ ਆ ਜਾਂਦਾ ਹੈ ਜੋ ਕਿ ਹਜੇ ਸਰਕਾਰ ਨੇ ਸ਼ੁਰੂ ਵੀ ਨਹੀਂ ਕੀਤੀਆਂ ਹੁੰਦੀਆਂ ਉਹ ਮੋਬਾਇਲ ਵਿੱਚ ਆ ਜਾਂਦੀਆਂ ਹਨ ਅਤੇ ਝੂਠੀਆਂ ਖਬਰਾਂ ਵੀ ਕਈ ਵਾਰ ਮੋਬਾਇਲ ਵਿੱਚ ਆ ਜਾਂਦੀਆਂ ਹਨ ਸਾ ਮੇਰੀ ਰਾਏ ਵਿੱਚ ਤਾਂ ਮੋਬਾਇਲ ਫੀਡ ਵਿੱਚ ਖਬਰਾਂ ਬਹੁਤ ਹੀ ਜ਼ਿਆਦਾ ਝੂਠੀਆਂ ਹੁੰਦੀਆਂ ਹਨ ਜੋ ਕਿ ਇੱਕ ਮਾੜੀ ਇੱਕ ਹੱਦ ਤੱਕ ਬਹੁਤ ਹੀ ਗਲਤ ਗੱਲ ਹੈ ਅਖ਼ਬਾਰਾਂ ਅਖ਼ਬਾਰਾਂ ਨੂੰ ਸਭ ਤੋਂ ਸਹੀ ਖਬਰਾਂ ਮਿਲ ਜਾਂਦੀਆਂ ਹਨ ਅਖ਼ਬਾਰਾਂ ਵਿੱਚ ਤਾਂ ਕਈ ਹੱਦ ਤੱਕ ਆਪਣੇ ਨੇੜੇ ਤੇੜੇ ਦੀਆਂ ਗੱਲਾਂ ਸਹੀ ਹੁੰਦੀਆਂ ਹਨ ਰੇਡੂਏ ਵਿੱਚ ਤਾਂ ਨਾ ਤਾਂ ਕੋਈ ਅਸੀਂ ਕਿਸੇ ਨੂੰ ਦੇਖ ਸਕਦੇ ਹਾਂ ਅਤੇ ਨਾ ਹੀ ਉਹ ਸਾਨੂੰ ਦੇਖ ਸਕਦੇ ਹਨ ਜਿਸ ਨਾਲ ਕਿ ਸਿਰਫ਼ ਉਸ ਵਿੱਚ ਆਵਾਜ਼ ਹੀ ਆਉਂਦੀ ਹੈ ਹੈ ਉਸ ਬਾਰੇ ਪਤਾ ਨਹੀਂ ਕਿ ਕਈ ਵਾਰ ਖਬਰਾਂ ਉਸ ਵਿੱਚ ਸਹੀ ਹੀ ਹੁੰਦੀਆਂ ਹਨ ਕਈ ਵਾਰ ਜੋ ਖਬਰਾਂ ਅਖ਼ਬਾਰ ਅਤੇ ਰੇਡੂਏ ਵਿੱਚ ਚਲਾਈਆਂ ਜਾਂਦੀਆਂ ਹਨ ਉਹ ਮੋਬਾਇਲ ਵਿੱਚ ਬਿਲਕੁਲ ਵੀ ਨਹੀਂ ਆਉਂਦੀਆਂ ਜਿਸ ਨਾਲ ਕਈ ਲੋਕਾਂ ਨੂੰ ਤਾਜੀਆਂ ਖਬਰਾਂ ਬਾਰੇ ਪਤਾ ਨਹੀਂ ਚੱਲਦਾ